ਅੱਜ ਦੇ ਬਦਲ ਰਹੇ ਵਾਤਾਵਰਨ ਨਾਲ ਮਨੁੱਖ ਦੀ ਸਿਹਤ ਉੱਤੇ ਬਹੁਤ ਹੀ ਅਸਰ ਪੈ ਰਿਹਾ ਹੈ ਜੇਕਰ ਦੇਖਿਆ ਜਾਵੇ ਤਾਂ ਉਪਲੱਬਧ ਹਸਪਤਾਲਾਂ ਅਤੇ ਡਾਕਟਰੀ ਸੇਵਾਵਾਂ ਦੇਸ਼ ਵਿੱਚ ਕਾਫੀ ਅ ਹੱਦ ਤੱਕ ਸੁਧਾਰ ਵੀ ਆਇਆ ਹੈ ਜਿਸ ਦੇ ਨਾਲ ਦੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਬਹੁਤ ਹੀ ਵੱਡਾ ਰੋਲ ਹੈ ਜਿਵੇਂ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਕਿਫਾਇਤੀ ਮਤਲਬ ਮੁਫ਼ਤ ਇਲਾਜ ਉਪਲੱਬਧ ਕਰਵਾ ਰ ਹੋਏ ਰਹੇ ਨੇ ਟੈਸਟ ਫਰੀ ਹੋ ਰਹੇ ਨੇ ਅਤੇ ਦਵਾਈਆਂ ਫਰੀ ਮਿਲ ਰਹੀਆਂ ਨੇ ਜੇਕਰ ਹੁਣ ਆਪਾਂ ਦੇਸ਼ ਦੇ ਲੈਵਲ 'ਤੇ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਵੱਲੋਂ ਵੀ ਕਾਫੀ ਸਿਹਤ ਸੁਧਾਰ ਵਿੱਚ ਬਜਟ ਦੇ ਵਿੱਚ ਵੀ ਬਹੁਤ ਹੀ ਵਾਧਾ ਕੀਤਾ ਗਿਆ ਅਤੇ ਨਾਲ ਹੀ ਜਨਰਿਕ ਦਵਾਈਆਂ ਦੇ ਸਟੋਰ ਵੀ ਖੋਲ੍ਹੇ ਗਏ ਜਿਸ ਦੇ ਵਿੱਚ ਕਿਫਾਇਤੀ ਰੇਟਾਂ 'ਤੇ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਨੇ ਹੋਰ ਹੋਰ ਦੇਖਿਆ ਜਾਵੇ ਜਿੱਦਾਂ ਕਿ ਕੋਵਿਡ ਨਾਇਨਟੀਨ ਮਹਾਂਮਾਰੀ ਦੇ ਦੌਰਾਨ ਆਕਸੀਜਨ ਦੀ ਕਮੀ ਦੇ ਕਾਰਨ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਵੀ ਲਗਾਏ ਗਏ ਸਨ ਜਦੋਂ ਕੋਵਿਡ ਨਾਇਨਟੀਨ ਮਹਾਂਮਾਰੀ ਸੀ ਉਦੋਂ ਬਹੁਤੀ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿੱਦਾਂ ਕਿ ਖਾਣਾ ਅਤੇ ਆਪਣਾ ਅੱਗੇ ਦੀ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਆ ਉਸ ਉਸ ਦੇ ਵਿੱਚ ਇੱਕ ਘਰ ਇੱਕ ਘਰ ਦੇ ਅੰਦਰ ਬੰਦ ਰਹਿਣਾ ਉਹ ਵੀ ਕਾਫੀ ਹੱਦ ਤੱਕ ਇੱਕ ਅਲੱਗ ਅਨੁਭਵ ਸੀ ਜਿਸ ਦੇ ਵਿੱਚ ਔਨਲਾਈਨ ਐਜੂਕੇਸ਼ਨ ਸਿਸਟਮ ਔਨਲਾਈਨ ਪੜ੍ਹਾਈ ਅਤੇ ਅਪ ਅਤੇ ਖਾਣਾ ਜਿਹੜਾ ਇਹ ਖਾਣਾ ਸਪਲਾਈ ਹੁੰਦਾ ਸੀ ਘਰ ਘਰ ਤੱਕ ਅਤੇ ਇਹ ਵੀ ਕ ਅ ਕਾਫੀ ਅਲੱਗ ਤਰੀਕੇ ਨਾਲ ਚੱਲ ਰਿਹਾ ਸੀ ਅਤੇ ਸਾਡੇ ਘਰ ਦੇ ਵਿੱਚ ਪੈਸਿਆਂ ਦੀ ਦਿੱਕਤ ਹੋਈ ਅਤੇ ਔਨਲਾਈਨ ਐਜੂਕੇਸ਼ਨ ਸਿਸਟਮ ਜਿਹੜਾ ਕਾਲਜਾਂ ਵਿੱਚ ਪੜ੍ਹਾਈ ਜਿਹੜੀ ਆ ਉਹ ਔਨਲਾਈਨ ਹੋ ਗਈ ਔਨਲਾਈਨ ਪੇਪਰ ਹੋਏ ਅਤੇ ਕਾਫੀ ਹੱਦ ਤੱਕ ਪੜ੍ਹਾਈ ਵੀ ਪਿੱਛੇ ਰਹਿ ਗਈ ਅਤੇ ਬਾਕੀ ਜਿਹੜਾ ਦੇਖਿਆ ਜਾਵੇ ਤਾਂ ਹੋਰ ਬਿਹਤਰ ਹਸਪਤਾਲਾਂ ਵਿੱਚ ਵੀ ਕਾਫੀ ਤਬਦੀਲੀ ਆਈ ਆ ਜਿੱਦਾਂ ਕਿ ਨਵੇਂ ਪਲਾਂਟ ਨਵੀਂ ਮਸ਼ੀਨਾਂ ਲੱਗੀਆਂ ਨੇ ਅਤੇ ਉਹਨਾਂ ਨਾਲ ਵੀ ਕਿਫਾਇਤੀ ਰੇਟਾਂ 'ਤੇ ਉਹਨਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਅਤੇ ਖੇਤਰ ਵਿੱਚ ਜੇ ਸਹੀ ਤਰੀਕੇ ਨਾਲ ਵਿਕਾਸ ਸਿਹਤ ਸੁਧਾਰ ਕਰਨਾ ਹੈ ਤਾਂ ਹੋਰ ਵੀ ਅ ਨਵੇਂ ਨਵੇ